ਪੰਜ ਜਨਵਰੀ ਉੱਨੀ ਸੌ ਇਕਾਨਵੇਂ ਦਸ ਫਰਵਰੀ ਉਨੀ ਸੌ ਅਠਾਨਵੇਂ ਨੌ ਮਈ ਦੋ ਹਜ਼ਾਰ ਪੰਦਰਾਂ ਨਵੰਬਰ ਦੋ ਹਜ਼ਾਰ ਵੀਹ ਸੌਲ੍ਹਾਂ ਅਕਤੂਬਰ ਦੋ ਹਜ਼ਾਰ ਤੇਈ